ਸਾਲ ਦੋ ਹਜ਼ਾਰ ਵਿੱਚ ਮੈਂ ਆਪਣੇ ਕਸਬੇ ਭਿੱਖੀ ਵਿਖੇ ਮਾਰਸ਼ਲ ਆਰਟ ਦੀ ਸ਼ੁਰੂਆਤ ਕੀਤੀ ਜਦੋਂ ਮੈਂ ਮਾਰਸ਼ਲ ਆਰਟ ਦੀ ਸ਼ੁਰੂਆਤ ਕੀਤੀ ਸੀ ਉਦੋਂ ਇਹ ਸਿੱਖਣਾ ਬਹੁਤ ਮੁਸ਼ਕਿਲ ਸੀ ਪਰ ਮੈਂ ਉਹ ਦਿਨਾਂ ਵਿੱਚ ਹਾਰ ਨਾ ਮੰਨੀ ਮੈਂ ਕਰਾਟੇ ਤਾਈਕਵਾਂਡੋ ਜੁਡੋ ਗੇਮ ਕਰਦਾ ਰਿਹਾ ਪਹਿਲਾਂ ਬਹੁਤ ਮੁਸ਼ਕਿਲਾਂ ਆਈਆਂ ਪਹਿਲਾਂ ਲੱਤਾਂ ਗੋਡਿਆਂ 'ਤੇ ਸੱਟਾਂ ਵੱਜਦੀਆਂ ਅਤੇ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ ਇਸਨੂੰ ਸਿੱਖਣਾ ਬਹੁਤ ਮੁਸ਼ਕਿਲ ਸੀ ਪਰ ਜਦੋਂ ਮੈਂ ਦਿਨੋ ਦਿਨ ਅਭਿਆਸ ਕਰਦਾ ਗਿਆ ਤਾਂ ਮੇਰੇ ਲਈ ਆਸਾਨ ਹੁੰਦਾ ਗਿਆ ਮੈਨੂੰ ਆਪਣੇ ਵਿੱਚ ਆਤਮ ਵਿਸ਼ਵਾਸ ਪੈਦਾ ਹੋਇਆ ਮਾਰਸ਼ਲ ਆਰਟ ਇਕ ਸਵੈ ਰੱਖਿਆ ਹੁਨਰ ਹੈ ਬਹੁਤ ਸਾਰੇ ਲੋਕ ਵੱਖ ਵੱਖ ਕਾਰਨਾਂ ਕਰਕੇ ਮਾਰਸ਼ਲ ਆਰਟ ਦੀ ਤੰਦਰੁਸਤੀ ਲਈ ਹੁਣ ਇਹ ਅਜ਼ਮਾਉਂਦੇ ਹਨ ਫਿਰ ਕਿਰਿਆ ਅਕਸਰ ਵਿਅਕਤੀਗਤ ਟੀਚਿਆਂ ਅਤੇ ਰੁਚੀਆਂ ਨਾਲ ਮੇਲ ਖਾਂਦੀ ਇੱਕ ਲ ਲੱਭਣ ਲਈ ਵੱਖ ਵੱਖ ਸ਼ੈਲੀਆਂ ਦੀ ਖੋਜ ਕਰਨ ਨਾਲ ਸ਼ੁਰੂ ਹੁੰਦੀ ਹੈ ਉਦਾਹਰਨ ਲਈ ਜੇਕਰ ਕੋਈ ਸਟਰਾਇਕਿੰਗ ਤਕਨੀਕਾਂ ਅਤੇ ਇੱਕ ਰਿਵਾਇਤੀ ਮਾਰਸ਼ਲ ਆਰਟ ਅਨੁਸ਼ਾਸਨ ਵੱਲ ਖਿਚਿਆ ਜਾਂਦਾ ਹੈ ਉਹ ਕਰਾਟੇ ਜਾਂ ਤਾਈਕਵਾਂਡੋ ਬਾਰੇ ਵਿਚਾਰ ਰੱਖ ਸਕਦੇ ਹਨ ਜੇ ਉਹ ਜੂਝਣ ਅਤੇ ਪੇਸ਼ ਕਰਨ ਦੀ ਤਕਨੀਕਾਂ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ ਤਾਂ ਜੁਡੋ ਕਰਾਟੇ ਤਾਈਕਵਾਂਡੋ ਉਹ ਆਕਰਸ਼ਿਤ ਹੋ ਸਕਦੇ ਹਨ ਸ਼ੁਰੂਆਤ ਕਰਨ ਲਈ ਉਹ ਕਲਾਸਾਂ ਦਾ ਨਿਰੀਖਣ ਕਰਨ ਇਨਸਟਕਟਰਾਂ ਨੂੰ ਮਿਲਣ ਅਤੇ ਵਾਤਾਵਰਨ ਦਾ ਮੁਲਾਂਕਣ ਕਰਨ ਸਥਾਨਕ ਦੋਜੋ ਜਾਂ ਮਾਰਸਲ ਆਰਟ ਸਕੂਲਾਂ ਵਿੱਚ ਵੀ ਸਿਖਾਏ ਜਾਂਦੇ ਹਨ ਇਹ ਸ਼ੁਰੂਆਤੀ ਫੇਰੀ ਮਾਹੌਲ ਨੂੰ ਮਾਪਣ ਅਤੇ ਨਿਰਧਾਰਿਤ ਕਰਨ ਵਿੱਚ ਮਦਦ ਕਰਦੀ ਹੈ ਕਿ ਇਹ ਸਿੱਖਣ ਅਤੇ ਵਿਕਾਸ ਲਈ ਉਹਨਾਂ ਦੀਆਂ ਉਮੀਦਾਂ ਦਾ ਮੇਲ ਖਾਂਦਾ ਹੈ